ਤੁਸੀਂ ਮਨਪ੍ਰੀਤ ਟੇਲਰ ਬੋਲ ਰਹੇ ਹੋ ਐਕਚੂਲੀ ਨਾ ਮੈਂ ਡਰੈਸਿਸ ਸਟਿੱਚ ਕਰਵਾਉਣੀਆਂ ਸੀ ਮੈਰਿਜ ਦੇ ਰਿਗਾਰਡਿੰਗਲੀ ਅਤੇ ਇਸ ਕਰਕੇ ਮੈਂ ਕੋਲ ਕੀਤੀ ਸੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਵਧੀਆ ਸਟੀਚਿੰਗ ਕਰਦੇ ਹੋ ਅਤੇ ਪਲੀਜ਼ ਮੈਨੂੰ ਦੱਸ ਦੂੰਗੇ ਤੁਹਾਡੀ ਕੀ ਫੋਰਮੈਲਿਟੀਸ ਮਤਲਬ ਕੀ ਪ੍ਰਾਈਜ਼ ਲੈਂਦੇ ਹੋ ਸੂਟ ਸਟਿੱਚ ਕਰਨ ਦਾ

ਬਹੁਤ ਜ਼ਿਆਦਾ ਸਟੀਚਿੰਗ ਲੈਂਦੇ ਹੋ ਤੁਸੀਂ ਤੁਸੀਂ ਸਟੀਚਿੰਗ ਤਾਂ ਬਹੁਤ ਜ਼ਿਆਦਾ ਲੈਂਦੇ ਹੋ ਤੁਸੀਂ ਸਟੀਚਿੰਗ ਤਾਂ ਐਕਚੁਲੀ ਮੈਨੂੰ ਥੁ ਤੁਹਾਡੀ ਨਾ ਮੈਨੂੰ ਪ੍ਰੇਜ ਸੁਣੀ ਸੀਗੀ ਤੁਸੀਂ ਬਹੁਤ ਪਰਫੈਕਟ ਹੈਗੇ ਹੋ ਅਤੇ ਮੈਂ ਨਾ ਮੈਰਿਜ ਦੇ ਰਿਗਾਰਡਿੰਗਲੀ ਘੱਟੋ ਘੱਟ ਅੱਠ ਦਸ ਸੂਟ ਤਾਂ ਸਾਡੇ ਹੋ ਹੀ ਜਾਣਗੇ ਸਟਿੱਚ ਕਰਵਾਉਣ ਨੂੰ ਅਤੇ ਉਹ ਮੈਂ ਸੂ ਸੂਟ ਵੀ ਐਨ ਬਹੁਤ ਅੱਛੀ ਕੁਆਲਿਟੀ ਦੇ ਹੈਗੇ ਹੈ ਕਿਉਂਕਿ ਨੋ ਡਾਊਟ ਤੁਹਾਡੇ ਜੇ ਸਿੰਪਲ ਸੂਟ ਦੀ ਸੇਵਨ ਹੰਡਰਡ ਹੋਏਗੀ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਹੋਰ ਵੀ ਜ਼ਿਆਦਾ ਤੁਹਾਡਾ ਰੇਟ ਹੋਏਗਾ ਆਈ ਕਾਂਟ ਐਫੋਰਡ ਇਟ ਉਹ ਵੀ ਤੁਸੀਂ ਰੇਟ ਰੀਜਨੇਬਲ ਲਗਾ ਲਉ ਤਾਂ ਮੈਂ ਸੂਟ ਨਾ ਤੁਹਾਤੋਂ ਕਾਫ਼ੀ ਸਾਰੇ ਸਟਿੱਚ ਕਰਵਾਉਣੇ ਆ ਅੱਠ ਦਸ ਸੂਟ ਸਟਿੱਚ ਕਰਵਾਉਣੇ ਹੈ

ਠੀਕ ਹੈ ਜੀ ਪਰ ਮੈਨੂੰ ਨਾ ਡਿਜ਼ਾਇਨਿੰਗ ਵੀ ਵਧੀਆ ਤੋਂ ਵਧੀਆ ਚਾਹੀਦੀ ਬਹੁਤ ਅੱਛੇ ਜਿਵੇਂ ਅੱਜ ਕੱਲ੍ਹ ਲੇਟੈਸਟ ਟਰੈਂਡਿੰਗ ਵਿੱਚ ਹੈਗੇ ਹੈ ਵੀ ਉੱਦਾਂ ਦੇ ਮੈਨੂੰ ਚਾਹੀਦੇ ਹੈ ਓਕੇ ਓਕੇ ਓਕੇ ਐਨ ਇੰਟਰਲੋਕ ਵਗੈਰਾ ਕਰਕੇ ਦਓਗੇ ਨਾ ਤੁਸੀਂ ਵੈਲ ਫਰਨਿਸਡ ਪ੍ਰੈੱਸਡ ਵਗੈਰਾ ਐਂਡ ਟੋਟਲੀ ਕਿਉਂਕਿ ਮੈਂ ਨਾ ਜਿਸ ਦਿਨ ਸਾਡੇ ਫੰਕਸ਼ਨ ਹੈਗਾ ਇੱਕ ਦਿਨ ਪਹਿਲਾਂ ਇੱਕ ਦਿਨ ਅਰਲੀਅਰ ਲੈ ਕੇ ਜਾਣੇ ਆ ਤੁਹਾਡੇ ਕੋਲੋਂ ਸੂਟ ਮੈਂ ਠੀਕ ਹੈ ਫੇਰ ਨਾ ਮੈਂ ਤੁਹਾਡੇ ਕੋਲ ਕੱਲ੍ਹ ਆਵਾਂਗੀ ਸੂਟ ਲੈ ਕੇ ਅਤੇ ਪਲੀਜ਼ ਰੀਜਨੇਬਲ ਥੋੜ੍ਹੇ ਜੈਨੂਅਨ ਜਿਹਾ ਰੇਟ ਲਗਾ ਲਿਓ ਠੀਕ ਹੈ ਹਾਂ ਓਕੇ ਥੈਂਕ ਯੂ ਮੈਂ ਕੱਲ੍ਹ ਆਵਾਂਗੀ ਓਕੇ ਜੀ ਥੈਂਕ ਯੂ ਸੋ ਮੱਚ ਜੀ ਥੈਂਕ ਯੂ